ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਜੇ ਮੈਂ ਇਸ ਦੇ ਵੱਖ ਵੱਖ ਖੇਤਰਾਂ ਦੀ ਗੱਲ ਕਰਾਂ ਤਾਂ ਇਸਦੇ ਵੱਖ ਵੱਖ ਖੇਤਰਾਂ ਵਿੱਚ ਤਕਰੀਬਨ ਜਿਹੜਾ ਤਾਪਮਾਨ ਹੈ ਜਾਂ ਮੌਸਮ ਹੈ ਉਹ ਲਗਭਗ ਵੱਖ ਵੱਖ ਹੁੰਦਾ ਜੇ ਮੈਂ ਗਰਮ ਅਤੇ ਖੁਸ਼ਕ ਇਲਾਕਿਆਂ ਦੀ ਗੱਲ ਕਰਾਂ ਭਾਰਤ ਦਾ ਜਿਹੜਾ ਪੱਛਮੀ ਅਤੇ ਮੱਧ ਭਾਗ ਹੈ ਉਹ ਬਹੁਤ ਖੁਸ਼ਕ ਹੈ ਇਸਦੇ ਵਿੱਚ ਜਿਹੜੇ ਇਲਾਕੇ ਆਉਂਦੇ ਹਨ ਉਹਨਾਂ ਦੇ ਵਿੱਚ ਜਿਵੇਂ ਕਿ ਜੋਧਪੁਰ ਹੋ ਗਿਆ ਜੈਸਲਮੇਰ ਸੋਲਾਪੁਰ ਜੋ ਕਿ ਰਾਜਸਥਾਨ ਦੇ ਵਿੱਚ ਸਥਿਤ ਨੇ ਉਹ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਆਉਂਦੇ ਨੇ ਇਸ ਤੋਂ ਬਾਅਦ ਜੇ ਮੈਂ ਠੰਡੇ ਇਲਾਕਿਆਂ ਦੀ ਗੱਲ ਕਰਾਂ ਤਾਂ ਭਾਰਤ ਦਾ ਜਿਹੜਾ ਉੱਤਰੀ ਭਾਗ ਹੈ ਉਹ ਠੰਡਾ ਹੈ ਉਹਦੇ ਵਿੱਚ ਸ਼ਿਮਲਾ ਸ਼੍ਰੀਨਗਰ ਅਤੇ ਸ਼ਿਲੋਂਗ ਵਰਗੇ ਸ਼ਹਿਰ ਆਉਂਦੇ ਨੇ ਇਸ ਤੋਂ ਬਿਨਾ ਭਾਰਤ ਵਿੱਚ ਤਕਰੀਬਨ ਚਾਰ ਤਰ੍ਹਾਂ ਦੀਆਂ ਰੁੱਤਾਂ ਆਉਂਦੀਆਂ ਨੇ ਜਿਵੇਂ ਕਿ ਸਰਦੀ ਦਾ ਮੌਸਮ ਗਰਮੀ ਦਾ ਮੌਸਮ ਮੌਨਸੂਨ ਦਾ ਮੌਸਮ ਅਤੇ ਮੌਨਸੂਨ ਤੋਂ ਬਾਅਦ ਦਾ ਮੌਸਮ ਆਉਂਦਾ ਸਭ ਤੋਂ ਪਹਿਲਾਂ ਗਰਮੀ ਦਾ ਮੌਸਮ ਜਿਹੜਾ ਕਿ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਅਤੇ ਜੂਨ ਦੇ ਮਹੀਨੇ ਦੇ ਆਸ ਪਾਸ ਸਮਾਪਤ ਹੋ ਜਾਂਦਾ ਹੈ ਕੁਝ ਇਲਾਕਿਆਂ ਵਿੱਚ ਜਿਹੜੀ ਗਰਮੀ ਹੈ ਬਹੁਤ ਕਠੋਰ ਹੁੰਦੀ ਹੈ ਜਿਵੇਂ ਕਿ ਰਾਜਸਥਾਨ ਦਾ ਇਲਾਕਾ ਹੋ ਗਿਆ ਉੱਥੋਂ ਦਾ ਤਾਪਮਾਨ ਇੱਕਵੰਜਾ ਬਵੰਜਾ ਡਿਗਰੀ ਸੈਲਸੀਅਲ ਤੱਕ ਪਹੁੰਚ ਜਾਂਦਾ ਅਤੇ ਆਮ ਕਰਕੇ ਗਰਮੀ ਦਾ ਜੋ ਤਾਪਮਾਨ ਹੈ ਉਹ ਬੱਤੀ ਡਿਗਰੀ ਸੈਲਸੀਅਲ ਤੋਂ ਲੈ ਕੇ ਚਾਲੀ ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਉਸ ਤੋਂ ਬਾਅਦ ਮੌਨਸੂਨ ਦਾ ਸਮਾਂ ਆ ਜਾਂਦਾ ਜੋ ਕਿ ਜੂਨ ਜੁਲਾਈ ਤੋਂ ਸ਼ੁਰੂ ਹੁੰਦੀ ਹੈ ਅਤੇ ਸਤੰਬਰ ਤੱਕ ਚਲਾ ਜਾਂਦਾ ਜ਼ਿਆਦਾਤਰ ਜਿਹੜੀ ਵਰਖਾ ਹੈਗੀ ਆ ਉਹ ਦੱਖਣ ਪੱਛਮ ਮੌਨਸੂਰਨ ਕਾਰਨ ਹੁੰਦੀ ਹੈ ਇਹ ਮੌਨਸੂਨ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਸ਼ੁਰੂ ਹੁੰਦੀ ਹੈ ਇਸ ਦੌਰਾਨ ਭਾਰੀ ਵਰਖਾ ਹੁੰਦੀ ਹੈ ਕਈ ਇਲਾਕੇ ਨੇ ਜਿਵੇਂ ਬਿਹਾਰ ਵਰਗੀਆਂ ਰਾਜ ਉਹਨਾਂ ਵਿੱਚ ਹੜਾਂ ਦੀ ਸਥਿਤੀ ਵੀ ਹੋ ਜਾਂਦੀ ਹੈ ਮੌਸਮ ਮੌਨਸੂਨ ਤੋਂ ਬਾਅਦ ਫਿਰ ਅਕਤੂਬਰ ਅਤੇ ਨਵੰਬਰ ਦਾ ਜਿਹੜਾ ਸਮਾਂ ਹੈ ਉਹ ਸ਼ੁਰੂ ਹੁੰਦਾ ਹੈ ਜੋ ਕਿ ਲੋਕਾਂ ਨੂੰ ਸਰਦੀਆਂ ਲਈ ਤਿਆਰ ਕਰਦਾ ਹੈ ਇਸ ਤੋਂ ਬਾਅਦ ਫਿਰ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਕਿਉਂਕੀ ਇਸਦਾ ਤਾਪਮਾਨ ਬਹੁਤ ਘੱਟ ਜਾਂਦਾ ਹੈ ਇਹ ਅਕਤੂਬਰ ਤੋਂ ਜਨਵਰੀ ਦੇ ਵਿਚਕਾਰ ਹੁੰਦੀ ਹੈ ਅਤੇ ਜਿਹੜਾ ਇੱਥੋਂ ਦਾ ਤਾਪਮਾਨ ਹੈ ਉਹ ਦਸ ਤੋਂ ਲੈ ਕੇ ਪੰਦਰ੍ਹਾਂ ਡਿਗਰੀ ਸੈਲਸੀਅਲ ਤੱਕ ਚਲਾ ਜਾਂਦਾ ਹੈ ਕਈ ਇਲਾਕੇ ਨੇ ਜਿਵੇਂ ਪੰਜਾਬ ਦੇ ਵੀ ਮੈਂ ਗੱਲ ਕਰਾਂ ਅੰਮ੍ਰਿਤਸਰ ਜਾਂ ਪਠਾਨਕੋਟ ਲਾਗੇ ਇਹ ਵੀ ਕਾਫੀ ਠੰਡੇ ਇਲਾਕੇ ਮੰਨੇ ਜਾਂਦੇ ਨੇ ਇਸ ਇਸਦੇ ਵਿੱਚ ਬਾਰਸ਼ ਦੇ ਨਾਲ ਨਾਲ ਬਰਫ ਵੀ ਪੈਂਦੀ ਹੈ ਦਸੰਬਰ ਜਨਵਰੀ ਮਹੀਨੇ ਸਭ ਤੋਂ ਠੰਡੇ ਹੁੰਦੇ ਨੇ ਦਿਨ ਦੇ ਮੁਕਾਬਲੇ ਜਿਹੜੇ ਰਾਤਾਂ ਨੇ ਉਹ ਲੰਬੀਆਂ ਹੁੰਦੀਆਂ ਨੇ ਸਰਦੀਆਂ ਤੋਂ ਬਾਅਦ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ ਬਹੁਤ ਵਧੀਆ ਮੌਸਮ ਹੁੰਦਾ ਹੈ ਕਿਉਂਕਿ ਸਾਨੂੰ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲਦੀ ਹੈ ਦਰਖਤਾਂ ਨੂੰ ਨਵੇਂ ਨਵੇਂ ਪੱਤੇ ਆਉਂਦੇ ਨੇ ਧੰਨਵਾਦ